ਮੈਂ ਪ੍ਰੇਮ ਸਿੰਘ ਵਾਸੀ ਮਿਰਜ਼ਾਪੁਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਇਹ ਬੁਣਾਈ ਅਤੇ ਸਿਖਲਾਈ ਤਕਨੀਕ ਬੁਣਾਈ ਉਸ ਨੂੰ ਕਹਿੰਦੇ ਨੇ ਕਿਸੇ ਵੀ ਚੀਜ਼ ਨੂੰ ਬਣਾਉਣਾ ਹੁੰਦਾ ਹੈ ਜਿੱਦਾਂ ਕਿ ਅਸੀਂ ਮੰਜਾ ਬਣਾਉਣਾ ਜਾਂ ਕੋਈ ਹੋਰ ਘਰ ਦਾ ਕੰਮ ਕੋਈ ਕਰਨਾ ਬਣਾ ਕੇ ਜਿੱਦਾਂ ਜਿੱਦਾਂ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਪਹਿਲਾਂ ਕੁੱਲੀਆਂ ਹੁੰਦੀਆਂ ਸਨ ਕੁੱਲੀਆਂ ਨੂੰ ਤਿਆਰ ਕਰਨ ਵਾਸਤੇ ਸਾਨੂੰ ਖੜ ਆਦਿ ਦੀ ਜ਼ਰੂਰਤ ਪੈਂਦੀ ਸੀਗੀ ਖੜ ਜਿਹੜੀ ਹੈ ਸਾਨੂੰ ਬਾਹਰੋਂ ਲਿਆ ਕੇ ਫਿਰ ਉਹਨੂੰ ਬੁਣ ਕੇ ਤਾਂ ਉਹ ਉਹਦੇ ਨਾਲ ਸਾਨੂੰ ਆਪਣਾ ਘਰ ਤਿਆਰ ਕਰਨਾ ਪੈਂਦਾ ਸੀ ਘਰ ਤਿਆਰ ਕਰਨਾ ਪੈਂਦਾ ਸੀ ਤਾਂ ਫਿਰ ਅਸੀਂ ਉਹਦੇ ਵਿੱਚ ਰਹਿਣਾ ਰਹਿਣਾ ਔਰ ਉਹਦੇ ਠੰਢੇ ਹੁੰਦੇ ਸੀ ਸਿਲਾਈ ਬੁਣਾਈ ਦੀ ਤਕਨੀਕ ਅੱਛੀ ਹੈ ਕਿਉਂਕਿ ਇਹ ਪੁਰਾਣੇ ਜ਼ਮਾਨਿਆਂ ਵਿੱਚ ਕਾਫੀ ਜ਼ਿਆਦਾ ਸੀਗੀ ਹੁਣ ਨਵੇਂ ਯੁਗ ਦੇ ਵਿੱਚ ਇਹ ਘਟਦੀ ਜਾ ਰਹੀ ਹੈ ਬੁਣਾਈ ਇੱਕ ਇਹੋ ਜਿਹੀ ਤਕਨੀਕ ਹੈ ਕਿ ਜਿਸ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਜਿੱਦਾਂ ਕੁਰਸੀਆਂ ਬਣਾਉਣਾ ਕਿਤਾਬਾਂ ਬਣਾਉਣਾ ਸਿਲਾਈ ਕਰਨਾ ਕੱਪੜੇ ਸਿਲਾਈ ਕਰਨਾ ਔਰ ਕਈ ਕੰਮ ਹਨ ਜਿੱਦਾਂ ਵੀ ਸਿਲਾਈ ਦਾ ਕੰਮ ਸਾਨੂੰ ਕੱਪੜੇ ਸਿਊਣ ਦੇ ਵਿੱਚ ਵੀ ਆਉਂਦਾ ਹੈ ਅਲੱਗ ਅਲੱਗ ਤਰ੍ਹਾਂ ਦੇ ਅੱਜ ਕੱਲ੍ਹ ਸੂਟਾਂ ਦੇ ਡਿਜ਼ਾਇਨ ਬਹੁਤ ਜ਼ਿਆਦਾ ਹਨ ਪੁਰਾਣੇ ਜ਼ਮਾਨੇ ਵਿੱਚ ਸੂਟਾਂ ਦੇ ਡਿਜ਼ਾਇਨ ਬਹੁਤ ਘੱਟ ਸੀਗੇ ਹੁਣ ਜਿਹੜੇ ਸੂਟਾਂ ਦੇ ਡਿਜ਼ਾਇਨ ਹੈ ਬਹੁਤ ਹੀ ਜ਼ਿਆਦਾ ਹੈ ਕਿਉਂਕਿ ਸਿਲਾਈ ਕਰਕੇ ਅਤੇ ਬੁਣਾਈ ਕਰਕੇ ਅਸੀਂ ਦੋਨੋਂ ਹੀ ਕਰ ਸਕਦੇ ਹਨ ਸਿਲਾਈ ਜਿਹੜੀ ਹੈ ਮਸ਼ੀਨ ਨਾਲ ਮਸ਼ੀਨ ਦੁਆਰਾ ਕੀਤੀ ਜਾਂਦੀ ਹੈ ਅਤੇ ਹੱਥ ਨਾਲ ਵੀ ਕੀਤੀ ਜਾਂਦੀ ਆ ਹੱਥ ਨਾਲ ਜਿਹੜੀ ਸਾਡੀ ਥੋੜ੍ਹੀ ਸਪੀਡ ਸਲੋ ਹੁੰਦੀ ਹੈ ਅਤੇ ਉਹਦੇ ਨਾਲ ਸਫਾਈ ਘੱਟ ਆਉਂਦੀ ਆ ਜੋ ਅਸੀਂ ਮਸ਼ੀਨ ਦੇ ਦੁਆਰਾ ਸਿਲਾਈ ਕੀਤੀ ਜਾਏਗੀ ਉਸ ਦੇ ਵਿੱਚ ਸਾਨੂੰ ਸਿੱਖਣਾ ਤਾਂ ਜ਼ਿਆਦਾ ਕੁਝ ਮਿਲਦਾ ਹੈ ਖੋਜਣ ਦੇ ਵਿੱਚ ਸਾਨੂੰ ਕਈ ਚੀਜ਼ਾਂ ਇਹੋ ਜਿਹੀਆਂ ਮਿਲਦੀਆਂ ਹਨ ਕਿ ਜਿੱਦਾਂ ਕਿ ਅਸੀਂ ਨਵੀਂ ਚੀਜ਼ ਦੀ ਤਕਨੀਕ ਲੈਣੀ ਹੈ ਉਹ ਸਾਨੂੰ ਨਵੀਂ ਤਕਨੀਕ ਸਾਨੂੰ ਮਸ਼ੀਨ ਦੇ ਦੁਆਰਾ ਹੀ ਮਿਲ ਸਕਦੀ ਹੈ ਕਿਉਂਕਿ ਮਸ਼ੀਨ ਹੀ ਇੱਕ ਇਹੋ ਜਿਹਾ ਜ਼ਰੀਆ ਹੈ ਕਿ ਹੁਣ ਸਾਨੂੰ ਸਿਲਾਈ ਬੁਣਾਈ ਕਢਾਈ ਇਹ ਸਾਰੀਆਂ ਚੀਜ਼ਾਂ ਸਾਨੂੰ ਧਿਆਨ ਦੇ ਨਾਲ ਕਰਨ ਦੇ ਨਾਲ ਸਾਨੂੰ ਇੱਕ ਤਾਂ ਡਿਜਾਇਨ ਵਧੀਆ ਪੈਂਦਾ ਹੈ ਦੂਸਰਾ ਕਿ ਇਹ ਇਹਦੇ ਵਿੱਚ ਸਾਨੂੰ ਸਿੱਖਣ ਬਹੁਤ ਚੀਜ਼ ਬਹੁਤ ਜ਼ਿਆਦਾ ਮਿਲਦੀ ਹੈ ਬੁਣਾਈ ਇੱਕ ਬਹੁਤ ਹੀ ਅੱਛਾ ਸਾਧਨ ਹੈ ਧੰਨਵਾਦ ਜੀ